ਸਤਿ ਸ਼੍ਰੀ ਅਕਾਲ ਵੀਰ ਜੀ ਗੁਰਪ੍ਰੀਤ ਇਲੈਕਟ੍ਰੋਨਿਕ ਬ ਦੁਕਾਨ ਤੋਂ ਬੋਲਦੇ ਹੋ ਯਾਰ ਵੀਰ ਜੀ ਇੱਥੋਂ ਨਾ ਅਸੀਂ ਲੈਪਟੋਪ ਮੰਗਵਾਇਆ ਸੀ ਉਹ ਨਾ ਇੱਕ ਤਾਂ ਲੈਪਟਾਪ ਆ ਕਿਹੜਾ ਪੋਸਪੋ ਤੁਸੀਂ ਨੇ ਸਾਨੂੰ ਦੋ ਤਿੰਨ ਦਿਨ ਲੇਟ ਭੇਜਿਆ ਜੇ ਉਹ ਬੰਦਾ ਦੇਣ ਵੀ ਆਇਆ ਸਾਨੂੰ ਉਹਦੇ ਦਾ ਵਿਹਾਰ ਕੁਛ ਠੀਕ ਨਹੀਂ ਥਾ ਅਤੇ ਉਹਨਾਂ ਨੇ ਆ ਕੇ ਇਸ ਤਰ੍ਹਾਂ ਸਿੱਟ ਦਿੱਤਾ ਕਿਵੇਂ ਕੋਈ ਚੀਜ਼ ਸਿੱਟੀ ਦੀ ਹੁੰਦੀ ਹੈ ਜਦੋਂ ਮੈਂ ਉਹਨੂੰ ਖੋਲ੍ਹ ਕੇ ਦੇਖਿਆ ਉਹ ਬਿਲਕੁਲ ਝਰੀਟਾਂ ਪਈਆਂ ਪਈਆਂ ਉਹਦਾ ਬਟਨ ਵੀ ਸਾਰੇ ਲੂਜ ਪਏ ਤੇ ਸਕਰੀਨ 'ਤੇ ਵੀ ਝਰੀਟਾਂ ਪਈਆਂ ਪਈਆਂ ਜਦੋਂ ਅਸੀਂ ਉਹਨੂੰ ਚਲਾਇਆ ਉਸ ਦੇ ਸਕਰੀਨ 'ਤੇ ਲਾਈਨਾਂ ਆ ਰਹੀਆਂ ਸੀਆਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ ਜਾਂ ਤਾਂ ਉਹਨੂੰ ਵਾਪਸ ਕਰਿਆ ਜਾਵੇ ਜਾਂ ਫਿਰ ਉਹਨੂੰ ਰਿਪਲੇਸ ਕਰਕੇ ਸਹੀ ਕੀਤਾ ਜਾਵੇ ਉਹਨੂੰ ਮੈਂ ਆਪ ਨੂੰ ਇਹ ਕਹਿ ਇਹ ਵੀ ਕਹਿਣਾ ਸੀ ਜੋ ਤੁਹਾਡਾ ਬੰਦਾ ਆਇਆ ਸੀ ਉਹਦਾ ਵਿਹਾਰ ਸਹੀ ਨਹੀਂ ਹੈਗਾ ਇਸ ਲਈ ਤੁਹਾਨੂੰ ਮੈਂ ਬੇਨਤੀ ਕਰਦਾ ਹੈ ਪਹਿਲੀ ਗੱਲ ਤਾਂ ਆਪ ਬ ਗਾਹਕ ਬਿਲਕੁਲ ਸਹੀ ਭੇਜਿਆ ਕਰੋ ਬੰਦਾ ਤਾਂ ਕਿ ਉਹ ਕਸਟਮਰ ਨੂੰ ਸਹੀ ਤਰੀਕੇ ਨਾਲ ਡੀਲਿੰਗ ਕਰੇ ਅਤੇ ਧੰਨਵਾਦ ਅਤੇ ਮੈਂ ਉਸ ਨੂੰ ਵਾਪਸ ਕਰਨ ਲਈ ਆਪਣੇ ਦੁਕਾਨ ਅਤੇ ਆਵਾਂਗਾ ਥੈਂਕ ਯੂ